ਸਾਡੇ ਦੇਸ਼ ਵਿੱਚ ਬੜੀਆਂ ਹੀ ਘੁੰਮਣ ਫਿਰਨ ਨੂੰ ਥਾਵਾਂ ਹਨ ਹਰ ਇੱਕ ਥਾਂ 'ਤੇ ਸਾਨੂੰ ਵਧੀਆ ਵਧੀਆ ਚੀਜ਼ਾਂ ਮਿਲ ਜਾਂਦੀਆਂ ਹਨ ਹੋਟਲ ਰਹਿਣ ਨੂੰ ਮਿਲ ਜਾਂਦੇ ਹਨ ਹਰ ਇੱਕ ਕਈ ਥਾਂ ਸਰਾਵਾਂ ਮਿਲ ਜਾਂਦੀਆਂ ਹਨ ਕਈ ਥਾਵਾਂ ਧਰਮਸ਼ਾਲਾ ਮਿਲ ਜਾਂਦੀਆਂ ਹਨ ਕਈ ਥਾਵਾਂ 'ਤੇ ਸਾਨੂੰ ਪੀ ਜੀ ਮਿਲ ਜਾਂਦੇ ਹਨ ਇਨ੍ਹਾਂ ਹਰ ਇੱਕ ਚੀਜ਼ ਦਾ ਹਰ ਖੇਤਰ ਦਾ ਬੜਾ ਵਧੀਆ ਵਧੀਆ ਮਾਹੌਲ ਹੈ ਜੇ ਆਪਾਂ ਹੋਟਲ ਦੀ ਗੱਲ ਕਰੀਏ ਹੋਟਲ ਵਿੱਚ ਸਾਨੂੰ ਵਧੀਆ ਵਧੀਆ ਚੀਜ਼ ਮਿਲ ਜਾਂਦੀ ਹੈ ਹਰ ਵਧੀਆ ਵੈਲ ਮੈਨਟੈਨ ਚੀਜ਼ ਮਿਲੇਗੀ ਹਰ ਇੱਕ ਖਾਣ ਪੀਣ ਖਾਣ ਪੀਣ ਨੂੰ ਵਧੀਆ ਮਿਲੇਗਾ ਫਾਈਵ ਸਟਾਰ ਹੋਟਲ ਦੀ ਗੱਲ ਕਰੀਏ ਤਾਂ ਹਰ ਇੱਕ ਚੀਜ਼ ਬਹੁਤ ਹੀ ਉੱਚ ਉੱਤਮ ਪੱਧਰ 'ਤੇ ਹੋਵੇਗੀ ਉਸ ਦਾ ਖਰਚਾ ਵੀ ਬਹੁਤ ਜ਼ਿਆਦਾ ਹੁੰਦਾ ਜੇਕਰ ਅਸੀਂ ਗੱਲ ਧਰਮਸ਼ਾਲਾ ਦੀ ਕਰੀਏ ਧਰਮਸ਼ਾਲਾ ਦੇ ਵਿੱਚ ਸਾਨੂੰ ਬਸ ਥੋੜ੍ਹੇ ਜਿਹੇ ਪੈਸੇ ਦੇਣੇ ਪੈਂਦੇ ਹਨ ਤਾਂ ਆਪਾਂ ਉਹਦੇ ਵਿੱਚ ਰਹਿ ਸਕਦੇ ਹਾਂ ਬਟ ਰੋਟੀ ਪਾਣੀ ਸਾਡਾ ਆਪਣਾ ਹੁੰਦਾ ਹੈ ਅਤੇ ਜੇਕਰ ਆਪਾਂ ਗੱਲ ਪੀ ਜੀ ਦੀ ਕਰੀਏ ਪੀ ਜੀ ਵਿੱਚ ਸਾਨੂੰ ਬਸ ਕੁੱਲ ਪੈਸੇ ਦੇਣੇ ਹੁੰਦੇ ਜਿਵੇਂ ਕਿ ਛੇ ਸੱਤ ਹਜ਼ਾਰ ਰੁਪਈਆ ਉਹਦੇ ਵਿੱਚ ਸਾਨੂੰ ਰੋਟੀ ਪਾਣੀ ਵੀ ਨਾਲ ਮਿਲਦਾ ਅਤੇ ਨਾਲ ਸਾਨੂੰ ਵਧੀਆ ਬੈਡਰੂਮ ਮਿਲਦੇ ਨੇ ਜਿਸ ਕਰਕੇ ਅਸੀਂ ਬੜੇ ਵਧੀਆ ਤਰੀਕੇ ਨਾਲ ਰਹਿ ਪੈਂਦੇ ਹਾਂ ਤੁਹਾਨੂੰ ਅੱਜ ਮੈਂ ਤੁਹਾਡੇ ਨਾਲ ਗੱਲ ਕਰਦਾ ਹਾਂ ਇਹ ਕਿ ਵਧੀਆ ਪੀ ਜੀ ਜੋ ਕਿ ਸਾਡੇ ਆਂਢ ਗੁਆਂਢ 'ਚ ਹੈਗਾ ਉਸ ਉਸ ਪੀ ਜੀ ਦਾ ਖਰਚਾ ਵੀ ਬਹੁਤ ਘੱਟ ਹੈ ਉਸ ਪੀ ਜੀ ਦਾ ਖਰਚਾ ਖਰਚਾ ਰੀਜਨੇਬਲ ਹੈ ਜਿਵੇਂ ਕਿ ਜੋ ਆਮ ਬੰਦਾ ਵੀ ਉਹਨੂੰ ਝੱਲ ਸਕਦਾ ਹੈ ਉਸ ਦਾ ਖਰਚਾ ਹੈ ਪੰਜ ਹਜ਼ਾਰ ਰੁਪਈਆ ਜਿਹਦੇ ਵਿੱਚ ਤੁਹਾਨੂੰ ਪੰਜ ਹਜ਼ਾਰ ਰੁਪਏ ਦੇ ਵਿੱਚ ਵਿੱਚ ਤੁਹਾਨੂੰ ਵਧੀਆ ਕਮਰੇ ਵਧੀਆ ਸਾਫ ਸੁਥਰਾ ਬਾਥਰੂਮ ਵਧੀਆ ਪਰਦੇ ਲੱਗੇ ਹੋਣਗੇ ਅਤੇ ਨਾਲੇ ਵਧੀਆ ਤੁਹਾਨੂੰ ਵਧੀਆ ਚੀਜ਼ਾਂ ਮਿਲਣਗੀਆਂ ਉਹਦੇ ਵਿੱਚ ਤੁਹਾਨੂੰ ਵਧੀਆ ਰੋਟੀ ਪਾਣੀ ਦਾ ਵੀ ਪ੍ਰਬੰਧ ਹੋਵੇਗਾ ਵਧੀਆ ਰੋਟੀ ਪਾਣੀ ਦੇ ਨਾਲ ਨਾਲ ਤੁਹਾਨੂੰ ਵਧੀਆ ਵਧੀਆ ਸਹੂਲਤਾਂ ਵੀ ਮਿਲਣਗੀਆਂ ਜਿਵੇਂ ਕਿ ਕਾਰ ਪਾਰਕਿੰਗ ਵੀ ਹੋਏਗੀ ਮੋਟਰਸਾਈਕਲ ਲਾਉਣ ਨੂੰ ਵੀ ਥਾਂ ਮਿਲੇਗਾ ਜੇਕਰ ਤੁਸੀਂ ਪਰ ਪੀ ਜੀ ਦੇ ਨਾਲ ਨਾਲ ਹੀ ਤੁਹਾਨੂੰ ਉੱਥੇ ਗੁਰਦੁਆਰਾ ਸਾਹਿਬ ਵੀ ਹੈ ਜਿੱਥੇ ਤੁਸੀਂ ਮੱਥਾ ਵੀ ਟੇਕ ਸਕਦੇ ਹੋ ਸ਼ਾਮ ਨੂੰ ਜਾ ਕੇ ਨਾਲੇ ਹੋਰ ਤਰ੍ਹਾਂ ਕਿ ਉੱਥੇ ਤੁਸੀਂ ਆਪਣਾ ਉਹ ਵੀ ਕਰ ਸਕਦੇ ਹੋ ਤੁਸੀਂ ਆਪਣਾ ਰਾਤ ਨੂੰ ਥੋੜ੍ਹਾ ਟਾਈਮ ਸਪੈਂਡ ਕਰ ਸਕਦੇ ਹੋ ਤੁਸੀਂ ਆਪਣੇ ਫੈਮਲੀ ਨੂੰ ਲੈ ਕੇ ਜਾ ਸਕਦੇ ਹੋ